ਮੈਂ ਰਾਮਦਾਸ ਪਿੰਡ ਨਵਾਂ ਗਰਾਮ ਤਸ ਡਾਕਖਾਨਾ ਸਜਾਨਪੁਰ ਤਹਿਸੀਲ ਅਤੇ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਅਤੇ ਮੈਂ ਜਦੋਂ ਤੀਜੀ ਜਮਾਤ 'ਚ ਪੜ੍ਹਦਾ ਸੀ ਤਾਂ ਮੇਰੇ ਅਧਿਆਪਕ ਸਨ ਸ ਸ਼੍ਰੀ ਦੇਵਰਾਜ ਗੁਪਤਾ ਕਥਲੋਰ ਤੋਂ ਅਤੇ ਉਹ ਦੇਖੋ ਪੜ੍ਹਨ ਦਾ ਮੈਨੂੰ ਸ਼ੌਕ ਸ਼ੁਰੂ ਤੋਂ ਸੀ ਮੈਂ ਆਪਣੀ ਜਮਾਤ ਦਾ ਮਨੀਟਰ ਹੁੰਦਾ ਸੀ ਅਤੇ ਉਹਨਾਂ ਉਹ ਮੈਂ ਉਹਨਾਂ ਦਾ ਮੇਰੇ ਨਾਲ ਬੜਾ ਲਗਾਵ ਸੀ ਇੱਕ ਵਾਰ ਉਹਨਾਂ ਨੇ ਮੈਨੂੰ ਇੱਕ ਚਿੱਤਰ ਬਣਾਉਣ ਨੂੰ ਦਿੱਤਾ ਕੌਲੀ ਦਾ ਚਿੱਤਰ ਬਣਾਉਣ ਨੂੰ ਅਤੇ ਉਹ ਚਿੱਤਰ ਮੈਂ ਦੇਖ ਕੇ ਬਣਾ ਲਿਆ ਬਹੁਤ ਵਧੀਆ ਬਣਾ ਲਿਆ ਅਤੇ ਮੇਰੀ ਅਧਿਆਪਕ ਨੇ ਇੰਨੀ ਪ੍ਰਸ਼ੰਸਾ ਕੀਤੀ ਇੰਨੀ ਪ੍ਰਸ਼ੰਸਾ ਕੀਤੀ ਕਿ ਕਹਿੰਦੇ ਕਿ ਗੁਰੂ ਦੀ ਜਿਹੜੀ ਪ੍ਰਸ਼ੰਸਾ ਔਰ ਹੌਸਲਾ ਅਫਜ਼ਾਈ ਜਿਹੜੀ ਹੈ ਬੰਦੇ ਨੂੰ ਕਿਤੇ ਤੋਂ ਕਿਤੇ ਪਹੁੰਚਾ ਦਿੰਦੀ ਹੈ ਅਤੇ ਉਹਨਾਂ ਦੀ ਉਹ ਪ੍ਰਸ਼ੰਸਾ ਜਾਂ ਉਹਨਾਂ ਦਾ ਉਹਨਾਂ ਦੀ ਉਹ ਪ੍ਰੇਰਨਾ ਨੇ ਮੈਨੂੰ ਉਹ ਪਹਿਲਾ ਚਿੱਤਰ ਬਣਾਉਣ ਤੋਂ ਬਾਅਦ ਇੰਨਾ ਕੁ ਉਤਸ਼ਾਹਿਤ ਕੀਤਾ ਕਿ ਮੈਂ ਆ ਕੇ ਚਿੱਤਰ ਬਣਾਉਣ ਦੇ ਵਿੱਚ ਮੇਰੀ ਰੁਚੀ ਹੋ ਗਈ ਅਤੇ ਮੈਂ ਫਿਰ ਚਿੱਤਰ ਜਿਹੜੇ ਆ ਆਪਣੇ ਧਾਰਮਿਕ ਚਿੱਤਰ ਬਣਾਉਣੇ ਜਿੱਦਾਂ ਸੁਗਰੀਬ ਬਾਲੀ ਦਾ ਚਿੱਤਰ ਬਣਾਇਆ ਅਤੇ ਜਿਹੜਾ ਕਿ ਮੇਰਾ ਮੁਹੱਲੇ ਦੇ ਔਰਤਾਂ ਨੇ ਵੀ ਬੜਾ ਸਲਾਹਿਆ ਮੁਹੱਲੇ ਦੇ ਬੱਚਿਆਂ ਨੇ ਬੜਾ ਸਲਾਹਿਆ ਇਸ ਤੋਂ ਬਾਅਦ ਮੇਰੀ ਮਤਲਬ ਕਿ ਚਿੱਤਰ ਬਣਾਉਣ ਦੇ ਵਿੱਚ ਬੜੀ ਰੁਚੀ ਹੋ ਗਈ ਅਤੇ ਆਪਣੇ ਜਿਹੜੇ ਹੈ ਮੇਰੇ ਸਹਿਪਾਠੀ ਮੇਰੇ ਜਮਾਤੀ ਵੀ ਜਿਹੜੇ ਆ ਉਹ ਮੇਰੇ ਚਿੱਤਰ ਦੀ ਬੜੀ ਪ੍ਰਸ਼ੰਸਾ ਕਰਦੇ ਅਤੇ ਇਹ ਚਿੱਤਰ ਫਿਰ ਮੈਂ ਮਤਲਬ ਕਿ ਚਿੱਤਰਕਾਰੀ ਜਿਹੜੀ ਮੈਂ ਉਹ ਮੇਰਾ ਇੱਕ ਹੋਬੀ ਬਣ ਗਿਆ ਮੇਰੇ ਇਕ ਸ਼ੁਗਲ ਬਣ ਗਿਆ